ਪੰਜਾਬ ਤਾਂ ਪੂਰਾ ਪੰਜਾਬ ਇੱਕ ਹੀ ਜਾਣਿਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਵੀ ਤਿੰਨ ਮੁੱਖ ਖੇਤਰ ਵੰਡੇ ਗਏ ਨੇ ਕਹਿੰਦੇ ਨੇ ਉਹਨਾਂ ਨੂੰ ਜਾਣੇ ਜਾਂਦੇ ਨੇ ਜਿਵੇਂ ਮਾਲਵਾ ਹੋ ਗਿਆ ਦੁਆਬਾ ਹੋ ਗਿਆ ਅਤੇ ਇੱਕ ਮਾਝਾ ਹੋ ਗਿਆ ਅਤੇ ਇੱਥੇ ਮਾਲਵਾ ਜਿਹੜਾ ਏਰੀਆ ਇੱਥੇ ਜਿਵੇਂ ਸਿੱਠਣੀਆਂ ਬੋਲੀਆਂ ਜਾਂਦੀਆਂ ਨੇ ਆਉਂਦੀ ਕੁੜੀਏ ਜਾਂਦੀ ਕੁੜੀਏ ਠੀਕ ਹੈ ਇੱਕ ਸਿਹਰਾ ਵਾਲਾ ਵੀਰਾ ਘੋੜੀ ਚੜ੍ਹਿਆ ਅਤੇ ਬਾਕੀ ਇਹ ਤਾਂ ਮਾਲਵੇ ਦੇ ਜਿਹੜੇ ਜਿਹੜਾ ਖੇਤਰ ਹੈ ਮੁੱਖ ਉੱਥੇ ਬਾਹਲੀ ਜਿੱਥੇ ਯੂਜ਼ ਕੀਤੀ ਜਾਂਦੀ ਬੋਲੀ ਜਾਂਦੇ ਨੇ ਉਹ ਹੈਗੇ ਜਿਹੜੇ ਆਪਣੇ ਲੋਕ ਗੀਤ ਉਹਦੇ ਇਲਾਵਾ ਪੂਰੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਗਿੱਧਾ ਬੋਲੀਆਂ ਅਤੇ ਇਹ ਹੈਗੇ ਕਈ ਇੱਥੇ ਦੇ ਪਰਟੀਕੁਲਰ ਜਿਹੜੇ ਪੁਰਾਣੇ ਚੱਲੇ ਆ ਰਹੇ ਨੇ ਬੋਲੀਆਂ ਪਾਉਂਦੇ ਨੇ ਵਿਆਹਾਂ 'ਤੇ ਸਿੱਠਣੀਆਂ ਬੋਲਦੇ ਨੇ ਅਤੇ ਕਈ ਲੋਕ ਗੀਤ ਵੀ ਬਾਹਲੇ ਫੇਮਸ ਨੇ ਇੱਥੇ ਉਹ ਸਾਰੇ ਚਲਦੇ ਨੇ ਅੱਡ ਅੱਡ ਏਰੀਏ ਦੇ ਵਿੱਚ ਅੱਡ ਅੱਡ ਟਾਈਪ ਦੇ ਲੋਕ ਗੀਤ ਲੋਕ ਸੁਣਦੇ ਨੇ